ਇੱਕ ਨਵੰਬਰ ਉੱਨੀ ਸੌ ਬਾਨਵੇਂ ਸਤਾਈ ਜੁਲਾਈ ਉੱਨੀ ਸੌ ਨੜ੍ਹਿਨਵੇਂ ਅਠਾਈ ਜੁਲਾਈ ਦੋ ਹਜ਼ਾਰ ਬਾਰ੍ਹਾਂ ਵੀਹ ਮਾਰਚ ਦੋ ਹਜ਼ਾਰ ਸੱਤ ਅਤੇ ਤੇਰ੍ਹਾਂ ਫਰਵਰੀ ਉੱਨੀ ਸੌ ਪਚਾਸੀ